ਹਾਂਜੀ ਮੈਂ ਅਮਨਦੀਪ ਮੈਂ ਇਹ ਕਹਿਣਾ ਸੀ ਤੁਹਾਨੂੰ ਕਿ ਮੈਂ ਪਟਿਆਲੇ ਤੋਂ ਰੋਪੜ ਜਾਣਾ ਹੈ ਤਾਂ ਵਾਇਆ ਮਤਲਬ ਫਤਿਹਗੜ੍ਹ ਵਿੱਚ ਦੀ ਜਾਣਾ ਪਵੇਗਾ ਫਤਿਹਗੜ੍ਹ ਇਸ ਟਾਈਮ ਸ਼ਹੀਦੀ ਜੋੜ ਮੇਲਾ ਚੱਲ ਰਿਹਾ ਜਿਸ ਕਾਰਨ ਰਸਤੇ 'ਚ ਬਹੁਤ ਟਰੈਫਿਕ ਹੈ ਇੱਕ ਤਾਂ ਤੁਸੀਂ ਮੈਨੂੰ ਥੋੜ੍ਹਾ ਬਹੁਤਾ ਟਰੈਫਿਕ ਬਾਰੇ ਦੱਸੋ ਕਿ ਕਿੰਨਾ ਕੁ ਟਾਈਮ ਮੈਨੂੰ ਲੱਗ ਜਾਵੇਗਾ ਤੁਹਾਡੀ ਟੈਕਸੀ ਮੈਂ ਬੁੱਕ ਕਰਨੀ ਹੈ ਠੀਕ ਹੈ ਤਾਂ ਮੈਂ ਪਹਿਲਾਂ ਆਲਰੇਡੀ ਪਟਿਆਲੇ ਤੋਂ ਹੀ ਲੇਟ ਹੋ ਗਈ ਹਾਂ ਜਦਕਿ ਮੈਂ ਉੱਥੇ ਗਿਆਰਾਂ ਵਜੇ ਪਹੁੰਚਣਾ ਸੀ ਅਤੇ ਨੌ ਵੱਜ ਚੁੱਕੇ ਨੇ ਇੱਥੇ ਵੀ ਅਜੇ ਮੈਨੂੰ ਪਤਾ ਨਹੀਂ ਮੈਨੂੰ ਕਿੰਨਾ ਕੁ ਹੋਰ ਟਾਈਮ ਲੱਗੇਗਾ ਸੋ ਪਲੀਜ਼ ਮੈਨੂੰ ਕਨਫਰਮ ਕਰ ਦਿਉ ਕਿ ਸਭਾ ਦੇ ਵਿੱਚ ਉੱਥੇ ਕਿੰਨਾ ਕੁ ਟਾਈਮ ਲੱਗੇਗਾ ਅਤੇ ਜਾਂ ਫਿਰ ਤੁਸੀਂ ਮੈਨੂੰ ਜਲਦੀ ਤੋਂ ਜਲਦੀ ਰੋਪੜ ਕਿੰਨੇ ਟਾਈਮ ਤੱਕ ਪਹੁੰਚਾ ਸਕਦੇ ਹੋ ਤਾਂ ਟਰੈਫਿਕ ਦੀ ਪ੍ਰੋਬਲਮਸ ਪਲੀਜ਼ ਮੇਰੀ ਜ਼ਰੂਰ ਸਮਝ ਲੈਣਾ ਠੀਕ ਹੈ ਤਾਂ ਇਸ ਤੋਂ ਬਿਨਾ ਬਾਕੀ ਜਿਵੇਂ ਵੀ ਤੁਹਾਨੂੰ ਮੇਰਾ ਮੈਸੇਜ ਮਿਲਦਾ ਤਾਂ ਉਸਦਾ ਜਿੰਨੀ ਜਲਦੀ ਹੋ ਸਕੇ ਰਿਪਲਾਈ ਕਰ ਦੇਣਾ ਥੈਂਕ ਯੂ